ਪੰਜਾਬ ਵਿੱਚ ਬਹੁਤ ਸਾਰੇ ਲੋਕ ਰਚਨਾਤਮਕ ਕਵਿਤਾਵਾਂ ਕਹਾਣੀਆਂ ਲੇਖ ਆਦਿ ਜਿੱਥੇ ਪਹਿਲਾਂ ਲ ਇਕਾਂਤ ਵਿੱਚ ਬੈਠ ਕੇ ਲਿਖਦੇ ਹਨ ਉੱਥੇ ਅਖ਼ਬਾਰਾਂ ਰਸਾਲਿਆਂ ਰਾਹੀਂ ਦੁਨੀਆਂ ਤੱਕ ਪਹੁੰਚਾਉਂਦੇ ਹਨ ਇਸੇ ਤਰ੍ਹਾਂ ਜਿਹੜਾ ਕਲਾਤਮਕ ਗਿੱਧਾ ਭੰਗੜਾ ਆਦਿ ਜੋ ਵੀ ਟੈਲੈਂਟ ਹੁੰਦਾ ਹੈ ਉਹ ਜਾਂ ਸ਼ੋਸ਼ਲ ਮੀਡੀਆ ਰਾਹੀਂ ਜਾਂ ਟੀ ਵੀ ਚੈਨਲਾਂ ਰਾਹੀਂ ਲੋਕ ਪੇਸ਼ ਕਰਦੇ ਹਨ ਜਿੱਥੋਂ ਉਹ ਜਿੱਥੇ ਵਾਹਵਾ ਖੱਟਦੇ ਹਨ ਉੱਥੇ ਕਈ ਵਾਰ ਉਹਨਾਂ ਦਾ ਇਸੇ ਹੀ ਹੀ ਹਿਸਾਬ ਵਿੱਚ ਭਵਿੱਖ ਵੀ ਸੁਨਹਿਰਾ ਬਣ ਜਾਂਦਾ ਹੈ